ਹੈਲੋ ਯਾਰ ਮੈਂ ਨਾ ਤੇਰੇ ਨਾਲ ਗੱਲ ਕਰਨੀ ਸੀ ਮੈਂ ਨਾ ਆਪਣੇ ਮੋਬਾਈਲ ਦਾ ਬਿੱਲ ਭਰਿਆ ਹੈ ਭੁਗਤਾਨ ਕੀਤਾ ਮੈਨੂੰ ਉਹਦਾ ਸੁਨੇਹਾ ਆਇਆ ਪਰ ਮੈਨੂੰ ਨਾ ਯਕੀਨ ਨਹੀਂ ਆ ਕਿ ਉਹ ਸਹੀ ਹੈ ਕਿ ਗਲਤ ਹੈ ਮੈਨੂੰ ਸ਼ੰਕਾ ਇਹ ਹੈਗੀ ਹੈ ਕਿ ਮੈਂ ਜਿਹੜਾ ਬਿਲ ਭਰਿਆ ਉਹਦੀ ਰਕਮ ਹੈਗੀ ਸੀ ਸਾਢੇ ਚਾਰ ਸੌ ਅਤੇ ਜਿਹੜਾ ਮੈਨੂੰ ਸੁਨੇਹਾ ਆਇਆ ਇੱਕ ਪੁਸ਼ਟੀ ਸੁਨੇਹਾ ਜਿਹੜਾ ਮੈਨੂੰ ਮਿਲਿਆ ਉਹ ਉਹਦੇ ਵਿੱਚ ਜਿਹੜੀ ਰਕਮ ਹੈ ਉਹ ਕੁਝ ਹੋਰ ਹੈ ਅਤੇ ਉਹਦੇ ਵਿੱਚ ਜਿਹੜੀ ਆਈ ਡੀ ਹੁੰਦੀ ਆ ਟ੍ਰਾਂਜੈਸ਼ਨ ਆਈ ਡੀ ਹੁੰਦੀ ਹੈ ਉਹ ਵੀ ਕੁਝ ਹੋਰ ਹੈ ਉਹ ਵੀ ਅਲੱਗ ਹੈ ਅਤੇ ਯਾਰ ਮੈਨੂੰ ਨਾ ਸ਼ੰਕਾ ਹੈ ਕਿ ਉਹ ਵੀ ਸਹੀ ਹੈ ਕਿ ਗਲਤ ਹੈ ਮੇਰਾ ਮੋਬਾਈਲ ਦਾ ਜੋ ਸੀਗਾ ਸਿੰਮ ਹੈਗੀ ਆ ਉਹ ਪ੍ਰੀਪੇਡ ਆ ਅਤੇ ਮੈਂ ਉਹਦਾ ਬਿੱਲ ਭਰਿਆ ਸੀ ਅੱਜ ਸਵੇਰੇ ਅਤੇ ਹੁਣ ਮੈਨੂੰ ਸ਼ੰਕਾ ਇਹ ਹੀ ਹੈ ਮੈਨੂੰ ਉਹਦਾ ਪੁਸ਼ਟੀ ਸੁਨੇਹਾ ਤਾਂ ਆਇਆ ਲੇਕਿਨ ਉਹਦੇ ਵਿੱਚ ਜਿਹੜੀ ਰਕਮ ਹੈ ਉਹ ਵੀ ਗਲਤ ਹੈ ਅਤੇ ਜਿਹੜੀ ਉਹਦੇ ਵਿੱਚ ਆਈ ਡੀ ਹੁੰਦੀ ਆ ਇੱਕ ਟਰਾਂਸੈਕਸ਼ਨ ਆਈ ਡੀ ਉਹ ਵੀ ਗਲਤ ਹੈ ਹੁਣ ਮੈਨੂੰ ਇਹ ਹੀ ਲੱਗ ਰਿਹਾ ਹੁਣ ਮੈਨੂੰ ਇਹ ਹੀ ਸ਼ੱਕ ਹੈ ਕਿ ਉਹ ਸਹੀ ਹੈ ਜਾਂ ਨਹੀਂ ਸਹੀ ਹੈ ਮੈਂ ਯਾਰ ਪੁੱਛਣਾ ਸੀ ਕਿ ਇਹ ਹੁਣ ਕਿੱਦਾਂ ਮਤਲਬ ਕਿ ਇਹਨੂੰ ਸ਼ੰਕਾ ਨੂੰ ਦੂਰ ਕੀਤਾ ਜਾਂਨ ਜਾ ਸਕਦਾ ਹੈ ਮੈਨੂੰ ਤੇਰੀ ਥੋੜ੍ਹੀ ਮਦਦ ਚਾਹੀਦੀ ਸੀ ਵੈਸੇ ਇੱਦਾਂ ਹੁੰਦਾ ਨਹੀਂ ਹੈ ਆਮ ਤੌਰ 'ਤੇ ਜਾਂ ਫਿਰ ਮੈਂ ਸੋਚ ਰਹੀ ਹਾਂ ਕਿ ਮੈਂ ਇਹ ਉਹਦੇ ਸ ਸੈਂਟਰ 'ਤੇ ਜਾਵਾਂ ਫਿਰ ਆਪਣਾ ਜਾ ਕੇ ਪੁਸ਼ਟੀ ਕਰਾਂ ਕਿ ਯਾਰ ਸਹੀ ਹੈ ਜਾਂ ਨਹੀਂ ਹੈ ਕਿਉਂਕਿ ਸੁਨੇਹਾ ਤਾਂ ਜਿਹੜਾ ਆਇਆ ਉਹ ਮੈਨੂੰ ਆਈ ਡੀ ਉਹਦੇ ਵਿੱਚ ਸਹੀ ਨਹੀਂ ਦਿੱਤੀ ਵੀ ਨਾ ਰਕਮ ਸਹੀ ਆਈ ਆ ਧੰਨਵਾਦ